ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਸਿੰਘ ਹੈ ਮੈਂ ਪਠਾਨਕੋਟ ਵਿੱਚ ਰਹਿੰਦਾ ਹਾਂ ਜਿੱਦਾਂ ਕਿ ਇਹਨਾਂ ਦਾ ਪ੍ਰਸ਼ਨ ਹੈ ਪੰਜਾਬ ਵਿੱਚ ਪ੍ਰਮੁੱਖ ਤੈਕਨੋਲਜੀ ਸੈਕਟਰ ਜਾਂ ਉਦਯੋਗ ਕੀ ਹਨ ਜਿੱਦਾਂ ਪੰਜਾਬ ਵਿੱਚ ਬਹੁਤ ਹੀ ਸਾਰੇ ਆਈ ਟੀ ਸੈਕਟਰ ਹਨ ਕੰਪਿਊਟਰ ਸੈਂਟਰ ਖੁੱਲ੍ਹੇ ਹਨ ਬਹੁਤ ਪਾਵਰ ਪਲਾਂਟ ਲੱਗੇ ਹੋਏ ਹਨ ਜਿੱਦਾਂ ਕਿ ਅਗਰ ਦੇਖੀਏ ਤਾਂ ਸਾਡੇ ਦੇਸ਼ ਨੇ ਵੀ ਰਸ਼ੀਆ ਨਾਲ ਪਾਵਰ ਪਲੈਨ ਦੀ ਇੱਕ ਡੀਲ ਹੋਈ ਹੈ ਇਹ ਸੈਕਟਰ ਸਾਡੇ ਲਈ ਬਹੁਤ ਹੀ ਫ਼ਾਇਦੇਮੰਦ ਹਨ ਜੋ ਸਾਨੂੰ ਆਉਣ ਵਾਲੇ ਭਵਿੱਖ ਵਿੱਚ ਬਹੁਤ ਮਦਦ ਕਰਨਗੇ